ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਬ੍ਰਹਿਮੰਡ ਦੇ ਉੱਪਰ ਜਿਹੜੇ ਆ ਨੌ ਗ੍ਰਹਿ ਵਾ ਇਹ ਸਾਰੇ ਗ੍ਰਹਿ ਜਿਹੜੇ ਆ ਇੱਕ ਦੂਜੇ ਦੇ ਦੁਆਲੇ ਘੁੰਮਦੇ ਆ ਅਤੇ ਆਪਣੇ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਆਪਣੇ ਕਈ ਭਾਰਤੀ ਵਿਗਿਆਨੀ ਆ ਜੇ ਜਿਹੜੇ ਖੋਜ ਕਰਨ ਦੇ ਲਈ ਇਹਨਾਂ ਗ੍ਰਹਿਆਂ ਦੇ ਉੱਪਰ ਗਏ ਆ ਜਿਵੇਂ ਕਿ ਪਹਿਲਾਂ ਕਲਪਨਾ ਚਾਵਲਾ ਹੁਣ ਚੰਦਰਯਾਣ ਅਤੇ ਸਾਨੂੰ ਆਪਾਂ ਤਾਂ ਮਤਲਬ ਕਿ ਆਪਣੇ ਘਰ ਬੈਠ ਕੇ ਟੀ ਵੀ ਹੋ ਗਿਆ ਫੋਨ ਇਹਦੇ ਰਾਹੀਂ ਜਿਹੜੀ ਆ ਉੱਥੋਂ ਦੀ ਜਾਣਕਾਰੀ ਲੈ ਸਕਦੇ ਹਾਂ ਜਿਵੇਂ ਕਿ ਚੰਦਰਯਾਣ ਤੋਂ ਸਾਨੂੰ ਇਹ ਜਾਣਕਾਰੀ ਮਿਲੀ ਸੀ ਕਿ ਉੱਥੇ ਚੰਦਰਮਾ 'ਤੇ ਜੀਵਨ ਉਪਲਬਧ ਹੈਗਾ ਵਾ ਜਾਂ ਨਹੀਂ ਹੈਗਾ ਉਥੋਂ ਦੀ ਆਕਸੀਜਨ ਹਵਾ ਦੀ ਮਾਤਰਾ ਕਿਵੇਂ ਦੀ ਆ ਇਹਨਾਂ ਚੀਜ਼ਾਂ ਦਾ ਕੀ ਆ ਸਾਨੂੰ ਇਹ ਵਿਗਿਆਨੀਆਂ ਤੋਂ ਹੀ ਪਤਾ ਲੱਗਦਾ ਵਾ ਕਈ ਹੋਰ ਵੀ ਵਿਗਿਆਨ ਕਰਤਾ ਵਾ ਜਿਹੜੇ ਖੋਜ ਕਰਨ ਦੇ ਲਈ ਜਾ ਰਹੇ ਆ ਜਿਵੇਂ ਕਿ ਮੰਗਲ ਗ੍ਰਹਿ ਦੇ ਉੱਤੇ ਵੀ ਕੋਈ ਆਪਣੇ ਵਿਗਿਆਨੀ ਗਿਆ ਵਾ ਸਾਨੂੰ ਇਹਨਾਂ ਤੋਂ ਇਹ ਸੂਚਨਾ ਮਿਲੇਗੀ ਕਿ ਉਹਦੇ ਉੱਤੇ ਆਪਾਂ ਆਪਣਾ ਜੀਵਨ ਕਿਵੇਂ ਸਥਿਰ ਰਹੇਗਾ ਜਾਂ ਨਹੀਂ ਰਹੇਗਾ ਇਹਨਾਂ ਗੱਲਾਂ ਦੀ ਜਾਣਕਾਰੀ ਮਿਲਦੀ ਆ ਬ੍ਰਹਿਮੰਡ ਕੀ ਆ ਇਹ ਵੀ ਇੱਕ ਕੁਦਰਤੀ ਮਤਲਬ ਕਿ ਇੱਕ ਵਿਸ਼ਾਲ ਚੀਜ਼ ਹੈਗੀ ਆ ਆਪਾਂ ਆਪਣੇ ਘਰ ਦੂਰਬੀਨ ਰਾਹੀਂ ਇਹਨਾਂ ਚੀਜ਼ਾਂ ਨੂੰ ਵੇਖਦੇ ਹਾਂ ਇਹ ਜਿਹੜਾ ਵੇਖਣ ਦੇ ਵਿੱਚ ਵੀ ਆਪਾਂ ਨੂੰ ਚੀਜ਼ ਬਹੁਤ ਵਧੀਆ ਲੱਗਦੀ ਆ ਅਤੇ ਵੇਖ ਕੇ ਵੀ ਆਪਣੇ ਗਿਆਨ ਦੇ ਵਿੱਚ ਜਿਹੜਾ ਵਾ ਇਹਦੇ ਨਾਲ ਵਾਧਾ ਹੁੰਦਾ ਵਾ ਇਹ ਤਾਂ ਹੈ ਹੀ ਬੜੀ ਵਧੀਆ ਚੀਜ਼ ਹੈ